ਹਰ ਇੱਕ ਬੱਚੇ ਦੇ ਵਿੱਚ ਬਾਰਾਂ ਤੋਂ ਪੰਦਰਾਂ ਮਹੀਨਿਆਂ ਬਾਅਦ ਡਰਾਇੰਗ ਕਰਨਾ ਹੁਨਰ ਆ ਜਾਂਦਾ ਹੈ ਹਰ ਇੱਕ ਬੱਚੇ ਨੂੰ ਡਰਾਇੰਗ ਕਰਨੀ ਚਾਹੀਦੀ ਹੈ ਇਹ ਇੱਕ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਚੀਜ਼ ਹੈ ਡਰਾਇੰਗ ਕਰਨ ਨਾਲ ਬੱਚੇ ਦੇ ਵਿੱਚ ਇੱਕ ਹੁਨਰ ਪੈਦਾ ਹੁੰਦਾ ਹੈ ਅਤੇ ਇੰਟਰਸਟ ਪੈਦਾ ਹੁੰਦਾ ਹੈ ਡਰਾਇੰਗ ਕਰਨ ਨਾਲ ਇੱਕ ਉਤ ਬੱਚੇ ਵਿੱਚ ਉਤਸ਼ਾਹ ਵੱਧਦਾ ਹੈ ਅਤੇ ਇੱਕ ਕਲਾ ਜਾਗਦੀ ਹੈ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤਿੰਨ ਤੋਂ ਚਾਰ ਸਾਲ ਦਾ ਹੋ ਕੇ ਬੱਚੇ ਨੂੰ ਇਸ ਬਾਰੇ ਪੂਰੀ ਜਾਣਕਾਰੀ ਆ ਜਾਂਦੀ ਹੈ ਅਤੇ ਇਹ ਬਹੁਤ ਹੀ ਜ਼ਿਆਦਾ ਪ੍ਰੈਕਟਿਸ ਕਰਨ ਦੇ ਨਾਲ ਬੱਚਾ ਇਸ ਕੰਮ ਵਿੱਚ ਪਰਫੈਕਟ ਵੀ ਹੋ ਜਾਂਦਾ ਹੈ ਡਰਾਇੰਗ ਇੱਕ ਬਹੁਤ ਹੀ ਵਧੀਆ ਇੰਟਰ ਅਤੇ ਇੰਟਰਸਟਿੰਗ ਚੀਜ਼ ਹੈ ਜਿਸ ਨੂੰ ਕਰਨ ਦੇ ਨਾਲ ਅਪ ਮਾਇੰਡ ਫਰੈਸ਼ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਨੌਲੇਜ ਮਿਲਦੀ ਹੈ ਡਰਾਇੰਗ ਦਾ ਉੰਨੀ ਹੀ ਜ਼ਿਆਦਾ ਪਰਫੈਕਟ ਹੁੰਦੀ ਜਾਂਦੀ ਹੈ ਜਿੰਨੀ ਜ਼ਿਆਦਾ ਪ੍ਰੈਕਟਿਸ ਕੀਤੀ ਜਾਂਦੀ ਹੈ ਡਰਾਇੰਗ ਨੂੰ ਹੁਣ ਦਸ ਤੋਂ ਪੰਦਰਾਂ ਮੰਥ ਦੇ ਬਾਅਦ ਬੱਚਾ ਲਿਖਤੀ ਰੂਪ ਦੇ ਵਿੱਚ ਜਾਂ ਫਿਰ ਕੱਲ ਡਰਾਇੰਗ ਵਿੱਚ ਕਲਰ ਭਰਨ ਦੇ ਯੋਗ ਹੋ ਹੀ ਜਾਂਦਾ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਹੈ ਇਸ ਕੰਮ ਵਿੱਚ ਪਰਫੈਕਟ ਹੁੰਦਾ ਜਾਂਦਾ ਹੈ ਡਰਾਇੰਗ ਹਰ ਇੱਕ ਦੇ ਲਈ ਜ਼ਰੂਰੀ ਹੈ ਅਤੇ ਇਹ ਹਰ ਕਿਸੇ ਦੇ ਮਾਇੰਡ ਦੇ ਵਿੱਚ ਇਹ ਹੁਨਰ ਹੋਣਾ ਚਾਹੀਦਾ ਹੈ